ਹੈਲੋ ਸਤਿ ਸ਼੍ਰੀ ਅਕਾਲ ਸਰ ਸਵੀਗੀ ਸੈਂਟਰ ਤੋਂ ਬੋਲ ਰਹੇ ਮੇਰਾ ਨਾਮ ਸੁਖਮਨੀ ਕੌਰ ਹੈ ਮੈਂ ਕੁਝ ਕੁ ਦਿਨ ਪਹਿਲਾਂ ਸਵੀਗੀ ਤੋਂ ਇੱਕ ਔਡਰ ਪਾਇਆ ਸੀ ਮੇਰੇ ਕੁਝ ਦੋਸਤ ਕੈਨੇਡਾ ਤੋਂ ਆਏ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਕੁਝ ਖਾਣ ਲਈ ਮੰਗਵਾਉਣ ਬਾਰੇ ਕਿਹਾ ਮੈਂ ਸਵੀਗੀ ਤੋਂ ਕਈ ਵਾਰ ਔਡਰ ਕਰ ਚੁੱਕੀ ਹਾਂ ਅਤੇ ਮੈਨੂੰ ਇਹਦਾ ਨਤੀਜਾ ਵਧੀਆ ਲੱਗਿਆ ਹੈ ਜਿਹਦੇ ਕਰਕੇ ਮੈਂ ਸਵੀਗੀ ਤੋਂ ਇੱਕ ਔਡਰ ਪਾ ਦਿੱਤਾ ਜਿਹਦੇ ਵਿੱਚ ਮੈਂ ਕੁਛ ਪੀਜ਼ਾ ਬਰਗਰ ਫਰਾਈਜ ਅਤੇ ਕੋਲਡ ਡਰਿੰਕ ਦਾ ਔਡਰ ਦਿੱਤਾ ਸੀ ਮੇਰਾ ਬਿੱਲ ਕੁਝ ਦੋ ਹਜ਼ਾਰ ਰੁਪਏ ਦੇ ਲਗਭਗ ਬਣਿਆ ਸੀ ਮੈਂ ਔਡਰ ਦੀ ਪੇਮੈਂਟ ਔਨਲਾਈਨ ਹੀ ਪਾ ਦਿੱਤੀ ਸੀ ਪਰ ਅ ਔਡਰ ਨੂੰ ਅੱਧਾ ਪੌਣਾ ਘੰਟਾ ਹੋ ਚੁੱਕਿਆ ਸੀ ਅਤੇ ਮੈਨੂੰ ਔਡਰ ਦੀ ਸਮੇਂ ਸਿਰ ਪ੍ਰਾਪਤੀ ਨਾ ਹੋਣ ਕਾਰਨ ਮੈਨੂੰ ਬਾਹਰੋਂ ਖਾਣ ਲਈ ਮੰਗਵਾਉਣਾ ਪਿਆ ਮੈਨੂੰ ਔਡਰ ਕੀਤੇ ਨੂੰ ਅੱਜ ਪੰਜ ਦਿਨ ਹੋ ਚੁੱਕੇ ਹਨ ਪਰ ਮੈਨੂੰ ਇਸ ਦੀ ਪੇਮੈਂਟ ਅਜੇ ਤੱਕ ਵੀ ਨਹੀਂ ਮਿਲੀ ਮੇਰਾ ਭੁਗਤਾਨ ਅਟਕ ਚੁੱਕਾ ਹੈ ਜਿਹਦੇ ਕਰਕੇ ਮੈਨੂੰ ਸਵੀਗੀ ਕਸਟਮਰ ਸਰਵਿਸ 'ਤੇ ਅੱਜ ਕੋਲ ਕਰਨੀ ਪਈ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਪੈਸੇ ਜਲਦੀ ਤੋਂ ਜਲਦੀ ਅਕਾਊਂਟ ਵਿੱਚ ਪਾ ਦਿੱਤੇ ਜਾਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ